ਜਿੱਦਾਂ ਕਿ ਤੁਸੀਂ ਸਾਰੇ ਜਾਣੇ ਜਾਣਦੇ ਹੀ ਹੋ ਇਹ ਜ਼ਮਾਨਾ ਟੈਕਨੋਲੋਜੀ ਦਾ ਜ਼ਮਾਨਾ ਹੈ ਅਤੇ ਟੈਕਨੋਲੋਜੀ ਦੇ ਇਸ ਜ਼ਮਾਨੇ ਦੇ ਵਿੱਚ ਮੇਰਾ ਮਨਪਸੰਦੀਦਾ ਗੈਜਟ ਹੈ ਸਮਾਰਟ ਵਾਚ ਸਮਾਰਟ ਵਾਚ ਮੇਰਾ ਮਨ ਪਸੰਦ ਗੈਜਟ ਕਿਉਂ ਹੈ ਇਸ ਦੇ ਕਈ ਕਾਰਨ ਹਨ ਜਿਵੇਂ ਕਿ ਇੱਕ ਤਾਂ ਅਸੀਂ ਆਨ ਕਰਕੇ ਨਾਲ ਹੀ ਆਪਣੇ ਕੰਮ ਕਰਕੇ ਅਸੀਂ ਦੋਨੋਂ ਕੰਮ ਇਕੱਠੇ ਕਰ ਸਕਦੇ ਹਾਂ ਇਸ ਕਰਕੇ ਸਮਾਰਟ ਵਾਚ ਦੇ ਕਈ ਫਾਇਦੇ ਹਨ ਕੋਈ ਮੈਸੇਜ ਆ ਜਾਂਦਾ ਅਸੀਂ ਪਹਿਲੇ ਤਾਂ ਪਹਿਲੇ ਫੋਨ ਨੂੰ ਹੱਥ 'ਚ ਫੜੀਏ ਫਿਰ ਮੈਸੇਜ ਆਨ ਕਰੀਏ ਫਿਰ ਅਸੀਂ ਉਹਨੂੰ ਪੜ੍ਹ ਸਕਦੇ ਹਾਂ ਜਦਕਿ ਸਮਾਰਟ ਵਾਚ ਦੇ ਨਾਲ ਅਸੀਂ ਇਹਨੂੰ ਆਸਾਨੀ ਦੇ ਨਾਲ ਪੜ੍ਹਿਆ ਵੀ ਜਾ ਸਕਦਾ ਅਤੇ ਇਹਦੇ ਨਾਲ ਨਾਲ ਦੀ ਨਾਲ ਅਸੀਂ ਰਸੋਈ ਦੇ ਵਿੱਚ ਕੰਮ ਕਰਕੇ ਸਮਾਰਟ ਵਾਚ ਦੇ ਜ਼ਰੀਏ ਅਸੀਂ ਗੱਲ ਵੀ ਕਰ ਸਕਦੇ ਹਾਂ ਕਿਸੇ ਦੇ ਨਾਲ ਇਹਦੇ ਕਈ ਕਈ ਫਾਇਦੇ ਹਨ ਮੈਨੂੰ ਇਸ ਕਰਕੇ ਸਮਾਰਟ ਵਾਚ ਬਹੁਤ ਪਸੰਦ ਹੈ ਇੱਕ ਤਾਂ ਇਹ ਹਾਰਟਬੀਟ ਦੇ ਨਾਲ ਵੀ ਰਿਲੇਟਡ ਹੁੰਦੀ ਹੈ ਸਾਡੇ ਦਿਲ ਦੀ ਧੜਕਨ ਵੀ ਇਹ ਦੱਸਦੀ ਹੈ ਅਤੇ ਉਸ ਤੋਂ ਬਾਅਦ ਇਹ ਟਾਈਮ ਤਾਂ ਦੱਸਦੀ ਹੀ ਦੱਸਦੀ ਹੈ ਇਸ ਕਰਕੇ ਇਸ ਦੇ ਕਈ ਫਾਇਦੇ ਹਨ ਇਸ ਟੈਕਨੋਲੋਜੀ ਦੇ ਜ਼ਮਾਨੇ ਦੇ ਵਿੱਚ ਇਸ ਨੂੰ ਬਣਾਉਣ ਲਈ ਬਹੁਤ ਵੱਡਾ ਸਹਿਯੋਗ ਹੈ ਇਸ ਕਰਕੇ ਮੈਨੂੰ ਸਮਾਰਟ ਵਾਚ ਬਹੁਤ ਬਹੁਤ ਹੀ ਜ਼ਿਆਦਾ ਇਹ ਗੈਜਟ ਮੈਨੂੰ ਪਸੰਦ ਹੈ